ਟਰੇਡ ਮਿਲ ਅੱਜ ਕੱਲ੍ਹ ਹਰ ਇੱਕ ਦੀ ਜ਼ਰੂਰਤ ਬਣ ਚੁਕ ਦਾ ਜਾ ਰਿਹਾ ਹੈ ਲੋਕਾਂ ਦੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਲਈ ਉਹ ਟਰੇਡ ਮਿਲ ਦਾ ਇਸਤੇਮਾਲ ਕਰਦੇ ਹਨ ਕੁਝ ਲੋਕ ਅੱਜ ਕੱਲ੍ਹ ਵੇਖੋ ਵੇਖੀ ਇਸ ਨੂੰ ਆਪਣੇ ਘਰ ਵਿੱਚ ਲਿਆ ਰਹੇ ਹਨ ਅਤੇ ਕੁਝ ਜਿਸ ਵਿੱਚ ਜਹਾਂ ਇਸਦੀ ਵਰਤੋਂ ਕਰਦੇ ਹਨ ਇਹ ਅੱਜ ਕੱਲ੍ਹ ਰਿਵਾਜ ਜਿਹਾ ਬਣ ਗਿਆ ਹੈ ਇਸ ਲਈ ਸਰੀਰ ਦੀ ਵਰਜਿਸ਼ ਦੀ ਨਹੀਂ ਹੁੰਦੀ ਪਰ ਸਰੀਰ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ ਜਿਵੇਂ ਆਪਣਾ ਖੁੱਲ੍ਹੀ ਜਗ੍ਹਾ 'ਤੇ ਦੌੜਦਾ ਹਾਂ ਉਸ ਨਾਲ ਸਰੀਰ ਤੰਦਰੁਸਤ ਅਤੇ ਤਰੋ ਤਾਜ਼ਾ ਹੁੰਦਾ ਹੈ ਜ਼ਮੀਨ 'ਤੇ ਮੈਦਾਨਾਂ 'ਤੇ ਦੌੜਨ ਨਾਲ ਸਾਨੂੰ ਬਹੁਤ ਕੁਦਰਤੀ ਵਾਤਾਵਰਨ ਅਤੇ ਕਾਫੀ ਤੱਤ ਮਿਲਦੇ ਹਨ ਜੋ ਸਾਨੂੰ ਟਰੇਡ ਮਿਲ ਤੋਂ ਨਹੀਂ ਮਿਲ ਸਕਦੇ